ਸਤਿ ਸ਼੍ਰੀ ਅਕਾਲ ਜੀ ਸਰ ਮੈਂ ਚਰਨਜੀਤ ਬੋਲ਼ ਰਿਹਾ ਜੀ ਮੈਂ ਇੱਕ ਨਾ ਗੱਡੀ ਲੈਣ ਦੀ ਸਕੀਮ 'ਚ ਸੀਗਾ ਕਿਆ ਤੁਸੀਂ ਮੈਨੂੰ ਡਿਟੇਲ ਦੱਸ ਸਕਦੇ ਹੋ ਜੀ ਮੈਂ ਇਨੋਵਾ ਦਿੱਲੀ ਨੰਬਰ ਲੈਣਾ ਚਾਹੁੰਦਾ ਜੀ ਮੈਨੂੰ ਦਵਾ ਦਉ ਜੀ ਤੁਸੀਂ ਸੋਲ੍ਹਾਂ ਮੋਡਲ ਦਵਾ ਦਉ ਜੀ ਠੀਕ ਹੈ ਅਤੇ ਮੈਨੂੰ ਰੇਟ ਵਗੈਰਾ ਕਨਫਰਮ ਕਰ ਦੂੰਗੇ ਜੀ ਫੋਨ 'ਤੇ ਠੀਕ ਹੈ ਜੀ ਅਤੇ ਮੈਨੂੰ ਇਹ ਦੱਸੋ ਕਿ ਆਪਣੇ ਪਾ ਫਾਈਨਾਸ ਵਗੈਰਾ ਦਾ ਓਪਸ਼ਨ ਹੈ ਜੀ

ਅਤੇ ਇਨ੍ਹਾਂ ਆਰ ਓ ਆਈ ਵਗੈਰਾ ਕਿੰਨਾਂ ਹੁੰਦਾ ਰੇਟ ਆਫ ਇੰਟਰਸਟ ਜੀ ਠੀਕ ਹੈ ਜੀ

ਹਾਂਜੀ ਠੀਕ ਹੈ ਸਰ ਅਤੇ ਇੱਕ ਮੈਨੂੰ ਇਹ ਕਨਫਰਮ ਕਰਿਓ ਵੀ ਆਪਾਂ ਇਹਦੀ ਡਾਊਨ ਪੇਮੈਂਟ ਕਿੰਨੀ ਦੇ ਸਕਦੇ ਹਾਂ ਜੀ ਹਾਂਜੀ

ਠੀਕ ਹੈ ਜੀ ਅਤੇ ਇਹਦੇ ਵਾਸਤੇ ਮੈਨੂੰ ਕੇ ਵਾਈ ਸੀ ਵਗੈਰਾ ਕਿਆ ਰਹੇਗੀ ਠੀਕ ਹੈ ਜੀ ਠੀਕ ਹੈ ਅਤੇ ਗਰੰਟਰ ਵਗੈਰਾ ਦੀ ਜ਼ਰੂਰਤ ਹੈ ਜੀ ਇਸ ਲੋਨ 'ਚ ਠੀਕ ਹੈ ਠੀਕ ਹੈ ਚਲੋ ਮੈਂ ਤੁਹਾਡੇ ਡੀਲਰ 'ਤੇ ਵਿਜ਼ਟ ਡੀਲਰ ਪੁਆਇੰਟ 'ਤੇ ਵਿਜ਼ਿਟ ਕਰਦਾਂ ਜਾ ਕੇ ਮਿਲਦਾ ਜੀ ਫਿਰ ਮੈਂ ਓਕੇ ਥੈਂਕ